ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਮ ਬੋਲ ਰਿਹਾ ਜੀ ਤੁਸੀਂ ਕੌਣ ਮੈਮ ਠੀਕ ਹੈ ਜੀ ਠੀਕ ਹੈ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਓਕੇ ਜੀ ਹਾਂਜੀ ਹਾਂਜੀ ਹੋ ਜੂਗੀ ਮੈਮ ਪਲੇਸਮੈਂਟ ਜੋਬ ਲਈ ਹੋਜੂਗੀ ਤੁਹਾਡੀ ਤੁਸੀਂ ਬੀਸੀਏ ਕੀਤੀ ਹੋਈ ਐ ਠੀਕ ਹੈ ਜੀ ਅਤੇ ਮੈਮ ਕੀ ਕਿੰਨੇ ਪਰਸੈਂਟ ਮਾਰਕਸ ਆਏ ਤੁਹਾਡੇ ਟੋਟਲ ਮਿਲਾ ਕੇ ਮੈਕਸੀਮਮ ਸਾਰੇ ਮਤਲਬ ਕਿ ਅੱਛਾ ਸੈਵਨਟੀ ਪਰਸੈਂਟ ਆਏ ਠੀਕ ਹੈ ਜੀ ਮੈਮ ਹੋ ਜੂਗਾ ਕੋਈ ਗੱਲ ਨਹੀਂ ਜੋਬਸ ਅਵੇਲੇਬਲ ਹੈਗੇ ਆ ਜਿੱਦਾਂ ਮੈਮ ਆਪਣੇ ਹੈਗਾ ਗੌਰਮੈਂਟ ਕਾਲਜ ਹੈਗਾ ਇੱਥੇ ਵੀ ਇੱਕ ਉਹਨਾਂ ਨੂੰ ਕਲੈਰੀਕਲ ਡਿਪਾਰਟਮੈਂਟ ਦੇ ਵਿੱਚ ਚਾਹੀਦੀ ਸੀ ਕੰਪਿਊਟਰ 'ਤੇ ਚਾਹੀਦਾ ਸੀ ਪਰਸਨ ਇੱਕ ਅਤੇ ਮੈਂ ਉੱਥੋਂ ਦਾ ਵੀ ਤੁਹਾਨੂੰ ਮੈਂ ਕੋਂਟੈਕਟ ਸੈਂਡ ਕਰ ਦੂੰਗਾ ਤੁਹਾਡੇ ਪ੍ਰੋਵਾਈਡ ਕਰਵਾ ਦੂੰਗਾ ਤੁਹਾਨੂੰ ਮੈਂ ਤੁਹਾਡੇ ਤੁਸੀਂ ਆਪਦਾ ਮੇਲ ਜਾਂ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਜੀ ਅਤੇ ਜੀ ਜੀ ਮੈਮ ਮੈਨੂੰ ਨਾ ਆਪਣਾ ਰਿਜਊਮ ਕਰ ਦਿਓ ਜੀ ਵਟਸਐਪ ਮੇਰੇ ਇਸੇ ਨੰਬਰ 'ਤੇ ਕਰ ਦਿਓ ਜੀ ਵਟਸਐਪ ਹਾਂਜੀ ਹਾਂਜੀ ਅਤੇ ਇੱਕ ਮੈਮ ਹੋਰ ਹੈਗਾ ਇੱਥੇ ਆਪਣੇ ਰੁਪਾਨਾ ਹੈਗੀ ਹੈ ਜੀ ਮਿੱਲ ਹੈਗੀ ਪੇਪਰ ਮਿੱਲ ਹੈਗੀ ਹੈ ਜੀ ਅਤੇ ਉੱਥੇ ਵੀ ਚਾਹੀਦਾ ਕਲੈਰੀਕਲ ਡਿਪਾਰਟਮੈਂਟ ਦੇ ਵਿੱਚ ਹੈਗੀ ਹੈ ਨੀਡਸ ਕੈਂਡੀਡੇਟਸ ਦੀ ਅਤੇ ਤੁਹਾਨੂੰ ਅੱਛਾ ਪੇ ਆਊਟ ਵੀ ਅੱਛਾ ਮਿਲ ਜੂਗਾ ਜੀ ਤੁਹਾਨੂੰ ਅਤੇ ਹਾਂਜੀ ਹਾਂਜੀ ਮੈਮ ਅਦਰ ਡਾਕੂਮੈਂਟ ਮੈਮ ਇੱਕ ਆਪਦਾ ਰਜਿਊਮ ਸੈਂਡ ਕਰ ਦਿਓ ਅਤੇ ਤੁਹਾਡੇ ਜੋ ਗ੍ਰੈ ਕੀਤਾ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਇਹਦਾ ਡੀਐਮਸੀ ਜ਼ਰੂਰ ਸੈਂਡ ਕਰਿਓ ਜੇ ਜੀ ਮੈਮ ਪਲੱਸ ਟੂ ਦਾ ਕਰ ਦਿਓ ਅਤੇ ਇੱਕ ਆਪਣਾ ਆਹ ਗ੍ਰੈਜੂਏਸ਼ਨ ਦਾ ਕਰ ਦਿਓ ਜੀ ਮੈਮ ਹਾਂ ਇਹ ਤਾਂ ਨੀਡਸ ਹੁੰਦੀ ਆ ਇਹ ਤਾਂ ਜ਼ਰੂਰੀ ਹੁੰਦੇ ਆ ਤੁਹਾਡਾ ਇੱਕ ਰੈਜੀਰੈਂਸ ਕਰੋ ਜੇ ਸੈਂਡ ਆਧਾਰ ਕਾਰਡ ਸੈਂਡ ਕਰ ਦਿਓ ਪੈਨ ਕਾਰਡ ਸੈਂਡ ਕਰ ਦਿਓ ਜੇ ਬਾਕੀ ਮੈਮ ਜੋ ਤੁਹਾਡੀ ਪਲੇਸਮੈਂਟ ਹੋਵੇਗੀ ਉਸ ਤੋਂ ਬਾਅਦ ਤੁਹਾਨੂੰ ਮੈਂ ਕਾਲ ਕਰ ਦੂੰਗਾ ਜਿਹੜੇ ਵੀ ਆਪਣਾ ਦਾ ਜ਼ਰੂਰੀ ਦਸਤਾਵੇਜ਼ ਹੋਣਗੇ ਉਹ ਉਹ ਮੈਂ ਤੁਹਾਨੂੰ ਮੰਗਵਾ ਲੂੰਗਾ ਜੋ ਤੁਸੀਂ ਹੋਵੋਗੇ ਮੈਂ ਤੁਸੀਂ ਮੇਰੇ ਮੈਂ ਤੁਹਾਡੇ ਕੋਲ ਇਹ ਆ ਕੇ ਕਰਵਾ ਦੂੰਗਾ ਜਿੱਥੇ ਵੀ ਹੋਣੇ ਹੋਏ ਨਾ ਮੈਂ ਉੱਥੇ ਤੁਹਾਡਾ ਮੇਰਾ ਹੈਗਾ ਏ ਸਾਡਾ ਪਰਸਨ ਇੱਕ ਕੰਮ ਕਰਦਾ ਜਿਹੜਾ ਉੱਥੇ ਉਹ ਤੁਹਾਨੂੰ ਕਰਵਾ ਦੂੰਗਾ ਜੀ ਹਾਂਜੀ ਹਾਂਜੀ ਮੈਮ ਠੀਕ ਹੈ ਜੀ ਓਕੇ ਜੀ ਬਾਏ